ਜੇ ਮੇਰੀ ਫੋਟੋਗ੍ਰਾਫੀ ਦੀ ਗੱਲ ਕੀਤੀ ਜਾਵੇ ਤਾਂ ਮੈਨੂੰ ਪੰਛੀਆਂ ਦੀਆਂ ਫੋਟੋਆਂ ਖਿੱਚਣੀਆਂ ਬਹੁਤ ਵਧੀਆ ਲੱਗਦੀਆਂ ਮੈਂ ਸ਼ਾਮ ਨੂੰ ਜਦੋਂ ਕਿ ਸੂਰਜ ਡੁੱਬ ਰਿਹਾ ਹੁੰਦਾ ਉਦੋਂ ਮੈਂ ਪੰਛੀਆਂ ਨਾਲ ਫੋਟੋਆਂ ਖਿੱਚਦਾ ਅਤੇ ਜਾਂ ਡੁੱਬਦੇ ਹੋਏ ਸੂਰਜ ਦੀਆਂ ਫੋਟੋਆਂ ਖਿੱਚਣੀਆਂ ਮੈਨੂੰ ਬਹੁਤ ਵਧੀਆ ਲੱਗਦੀਆਂ ਮੈਂ ਸਵੇਰ ਜਾਂ ਸ਼ਾਮ ਦੇ ਮੌਸਮ ਢਲਦੇ ਹੋਏ ਮੌਸਮ ਦੀਆਂ ਫੋਟੋਆਂ ਖਿੱਚਣੀਆਂ ਬਹੁਤ ਵਧੀਆ ਲੱਗਦੀਆਂ ਮੈਨੂੰ ਅਤੇ ਮੈਂ ਚਿੜੀਆਂ ਅਤੇ ਤੋਤੇ ਗਟਾਰਾਂ ਜੋ ਵੀ ਪੰਛੀ ਨੇ ਉਹਨਾਂ ਦੀਆਂ ਫੋਟੋਆਂ ਖਿੱਚਦਾ ਰੈਂਡਮ ਫੋਟੋਆਂ ਖਿੱਚਣੀਆਂ ਮੈਨੂੰ ਬਹੁਤ ਵਧੀਆ ਲੱਗਦੀਆਂ ਅਤੇ ਸੋਹਣੇ ਸੋਹਣੇ ਜੋ ਫੁੱਲ ਹੁੰਦੇ ਨੇ ਫੁੱਲ ਵੇਲ ਆ ਵੇਲਾਂ ਦਰੱਖਤ ਝਾੜੀਆਂ ਇਹਨਾਂ ਦੀਆਂ ਫੋਟੋਆਂ ਮੈਂ ਕਲੈਕਟ ਕਰਦਾ ਮੈਨੂੰ ਜੋ ਕਿ ਕੁਦਰਤ ਅਤੇ ਕੁਦਰਤ ਕੁਦਰਤੀ ਮੈਨੂੰ ਫੋਟੋ ਬਹੁਤ ਖਿੱਚਣੀ ਬਹੁਤ ਵਧੀਆ ਲੱਗਦੀ ਆ ਅਤੇ